ਹਾਂਜੀ ਮੈਂ ਕਿਰਾਏ 'ਤੇ ਰਹਿੰਦੀ ਹਾਂ ਜੀ ਮੈਂ ਪੜ੍ਹਦੀ ਹਾਂ ਮੈਨੂੰ ਖਰਚਾ ਪਾਣੀ ਵਾਸਤੇ ਗੈਸ ਸਲੰਡਰ ਚਾਹੀਦਾ ਮੈਨੂੰ ਉਹ ਦਿੱਤਾ ਜਾਵੇ ਤਾਂ ਮੇਰੀ ਖਾਣੇ ਪੀਣੇ ਦਾ ਇੰਤਜ਼ਾਮ ਬਣਜੇ ਫਿਰ ਮੈਨੂੰ ਆਪਦਾ ਨੰਬਰ ਮੈਂ ਦੇ ਸਕਦੀ ਹਾਂ ਤੁਹਾਨੂੰ ਆਪਦਾ ਸਾਰਾ ਅਡਰੈਸ ਦੇ ਸਕਦੀ ਹਾਂ ਮੇਰਾ ਨਾਂ ਹੈਗਾ ਗੁਰਮੀਤ ਕੌਰ ਅੱਠ ਨੰਬਰ ਵਾਰਡ ਤਲਵੰਡੀ ਪੱਤੀ ਅਤੇ ਮੇਰਾ ਮਦਦ ਕਰ ਸਕਦੇ ਹੋ ਜੀ ਮੈਨੂੰ ਗੈਸ ਸਲੰਡਰ ਦੀ ਲੋੜ ਹੈ ਮੈਂ ਆਪਦਾ ਖਾਣਾ ਬਣਾ ਸਕਦੀ ਹਾਂ ਤੁਸੀਂ ਮੈਨੂੰ ਗੈਸ ਸਿਲੰਡਰ ਦੀ ਜ਼ਰੂਰ ਤੋਂ ਜ਼ਰੂਰ ਵਰਤੋਂ ਕਰੋ